ਹੈਲੋ ਸਰ ਗੁੱਡ ਗੁੱਡ ਈ ਗੁੱਡ ਈਵਨਿੰਗ ਸਰ ਸਰ ਮੈਂ ਪੰਜਾ ਮੈਂ ਇੱਕ ਬੁੱਕ ਖਰੀਦੀ ਸੀ ਪੰਜਾਬੀ ਸਾਹਿਤ ਕਲਾ ਹਾਂ ਉਹਨਾਂ ਦੀ ਬਹੁਤ ਸਾਰੀ ਬੈਡ ਈਸ਼ੂਜ਼ ਹੈ ਜਿਵੇਂ ਕਿ ਬਹੁਤ ਜ਼ਿਆਦਾ ਉਹ ਫਟੀਆ ਹੋਈਆ ਹੈ ਅਤੇ ਔਰ ਥੋੜ੍ਹਾ ਮਿਸ ਪ੍ਰਿੰਟ ਹੈ ਜਿਹਦੇ ਕਰਕੇ ਬਹੁਤ ਸਾਰੀ ਪ੍ਰੋਬਲਮ ਨੇ ਹਾਂਜੀ ਪੰਦਰ੍ਹਾਂ ਦਿਨ ਪਹਿਲਾਂ ਮੈਂ ਆਪ ਲੈ ਕੇ ਗਏ ਸੀ ਹਾਂਜੀ ਚੈੱਕ ਕੀਤਾ ਸੀ ਪਰ ਪੇਜ਼ ਜਿੱਦਾ ਪਰੋਪਰ ਸਹੀ ਨੀ ਹੈਗੇ ਉਹ ਫੱਟਣ ਜਲਦੀ ਫੱਟਣ ਲੱਗ ਗਏ ਉਹਦੀ ਪ੍ਰੋਬਲਮ ਆ ਰਹੀ ਹੈ ਫਿਰ ਉਹ ਪੇਜ਼ ਹਾਰਡ ਨਹੀਂ ਹੈ ਬਹੁਤ ਜ਼ਿਆਦਾ ਖ਼ਰਾਬ ਹੈ ਹਾਂਜੀ

ਹਾਂਜੀ ਮੈਂ ਚੇਂਜ ਕਰਨਾ ਚਾਹੁੰਦੀ ਹਾਂ ਹਾਂਜੀ ਸਰ ਸਰ ਔਨਲਾਈਨ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਸਰ ਹੋਰ ਬੁੱਕਸ ਕਿੰਨੀਆਂ ਕੋਈ ਸਰ ਹੋਰ ਬੁੱਕਸ ਕੋਈ ਪ੍ਰੋਵਾਈਡ ਹੋ ਸਕਦੀਆਂ ਹੋਰ ਦੱਸਿਓ ਕਿਹੜੀ ਕਿਹੜੀ ਹੈ ਮੇਰਾ ਪੰਜਾਬੀ ਸਾਹਿਤ ਮੇਰਾ ਪੰਜਾਬੀ ਸਾਹਿਤ ਹੈ ਹਾਂਜੀ ਹਾਂਜੀ ਠੀਕ ਹੈ ਓਕੇ